ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹਾਂ ਤੁਸੀਂ ਕਿੱਦਾਂ ਹੋ ਮੈਂ ਤੁਹਾਨੂੰ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਮੈਂ ਆਪਣੇ ਬੇਟੇ ਦੀ ਐਡਮਿਸ਼ਨ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਉਸਦਾ ਸਕੂਲ ਬਦਲਣਾ ਹੈ ਕੀ ਤੁਸੀਂ ਮੈਨੂੰ ਪਠਾਨਕੋਟ ਦੇ ਚੰਗੇ ਸਕੂਲਾਂ ਬਾਰੇ ਦੱਸ ਸਕਦੇ ਹੋ ਮੈਂ ਵੀ ਜੇ ਐੱਮ ਕੇ ਬਾਰੇ ਸੁਣਿਆ ਹੈ ਕੀ ਤੁਸੀਂ ਮੈਨੂੰ ਉੱਥੋਂ ਦੇ ਖਰਚੇ ਬਾਰੇ ਅਤੇ ਐਡਮਿਸ਼ਨ ਬਾਰੇ ਦੱਸ ਸਕਦੇ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਅਤੇ ਐਡਮਿਸ਼ਨ ਲਈ ਕੋਈ ਫੋਰਮ ਵਗੈਰਾ ਫਿਲ ਕਰਨਾ ਪੈਂਦਾ ਠੀਕ ਹੈ ਜੀ ਮੈਂ ਅੱਜ ਹੀ ਸਟਾਫ ਨਾਲ ਗੱਲ ਕਰ ਲਵਾਂਗੀ ਧੰਨਵਾਦ